ਟੈਕਸੀ ਰੇਲ ਗੱਡੀ ਕਿਸ਼ਤੀ ਹਵਾਈ ਜਹਾਜ਼ ਐਬੂਲੈਂਸ ਪੁਲਿਸ ਗੱਡੀ ਸਕੂਟਰ ਕਾਰ ਸਾਂਈਕਲ ਹੈਲੀਕੋਪਟਰ ਬਸ ਮਲਬਾ ਗੱਡੀ ਵੈਨ ਟਰੱਕ ਗੱਡਾ ਰੇੜ੍ਹਾ ਰਿਕਸ਼ਾ ਟਾਂਗਾ ਸਵਾਰੀ ਬੰਬੂ ਕਾਰਟ ਟੈਂਪੂ ਟਿੱਪਰ